ਤਿਉਹਾਰ ਦੇ ਦਿਨਾਂ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ ਦਿਵਾਲੀ ਦੇ ਦਿਨਾਂ ਵਿੱਚ ਅਸੀਂ ਆਦਿ ਪਕਵਾਨ ਬਣਾਉਂਦੇ ਹਨ ਜਲੇਬੀ ਪਕੌੜੇ ਆਦਿ ਵੀ ਬਣਾਏ ਜਾਂਦੇ ਹਨ ਅਤੇ ਹੋਰ ਲੋਹੜੀ ਦੇ ਤਿਉਹਾਰ 'ਤੇ ਅਸੀਂ ਮੁਗਫ਼ਲੀਆਂ ਆਦਿ ਦਾ ਵੀ ਇਸਤੇਮਾਲ ਕਰਦੇ ਹਨ